ਪੇਂਡੂ ਇਲਾਕਿਆਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਸਾਰਿਆਂ ਨਾਲੋਂ ਵੱਡਾ ਮੇਨ ਰਸਤਾ ਸੜਕਾਂ ਦਾ ਹੁੰਦਾ ਹੈ ਜੋ ਕਿ ਬਹੁਤ ਹੀ ਵਧੀਆ ਤਰੀਕੇ ਨਾਲ ਬਣਨੀਆਂ ਚਾਹੀਦੀਆਂ ਨੇ ਜਿਸ ਨਾਲ ਆਉਣ ਜਾਣ ਲਈ ਕਿਸੇ ਵੀ ਕਿਸਮ ਦੀ ਕੋਈ ਵੀ ਦਿੱਕਤ ਨਾ ਆ ਸਕੇ ਜਿਵੇਂ ਕਿ ਇੱਕ ਬੱਚੇ ਨੇ ਪੜ੍ਹਨ ਲਈ ਆਪਣੇ ਘਰ ਤੋਂ ਦੂਰ ਪੰਜਾਹ ਜਾਂ ਸੱਠ ਕਿਲੋਮੀਟਰ ਸ ਸਕੂਲ ਜਾਂ ਕੋਲਜ ਵਿੱਚ ਜਾਣਾ ਹੈ ਉਸ ਲਈ ਪ੍ਰਾਈਵੇਟ ਬੱਸ 'ਤੇ ਪਹਿਲਾਂ ਉਹਨੂੰ ਪਿੰਡ ਤੋਂ ਸਫਰ ਕਰਨਾ ਪੈਂਦਾ ਹੈ ਫਿਰ ਜਾ ਕੇ ਕਿਤੇ ਸਰਕਾਰੀ ਬੱਸ 'ਤੇ ਸਫਰ ਕਰਨਾ ਪੈਂਦਾ ਹੈ ਮੇਰੇ ਹਿਸਾਬ ਨਾਲ ਜਿੱਥੇ ਤੱਕ ਸਕੂਲ ਜਾਂ ਕਾਲਜ ਹੈ ਵੱਡੇ ਪਿੰਡਾਂ ਦੀਆਂ ਬੱਸਾਂ ਨੂੰ ਰੋਡਵੇਜ਼ ਦੀਆਂ ਬੱਸਾਂ ਸਰਕਾਰੀ ਰਾਹੀਂ ਬੱਚਿਆਂ ਨੂੰ ਸਕੂਲ ਜਾਂ ਕੋਲਜ ਭੇਜਣਾ ਚਾਹੀਦਾ ਹੈ ਜਿਸ ਨਾਲ ਬੱਚਿਆਂ 'ਤੇ ਕਿਸੇ ਵੀ ਤਰ੍ਹਾਂ ਦਾ ਬੋਝ ਅਤੇ ਲੋਡ ਨਹੀਂ ਪਵੇਗਾ ਜੋ ਕਿ ਬੱਚਾ ਆਪਣੀ ਜ਼ਿੰਦਗੀ ਆਪਣੇ ਵਧੀਆ ਤਰੀਕੇ ਨਾਲ ਸਟੱਡੀ ਕਰ ਸਕੇਗਾ ਜੋ ਅੱਜ ਦੇ ਯੁੱਗ ਵਿੱਚ ਜਿਸਨੇ ਸਟੱਡੀ ਕਰ ਲਈ ਉਸ ਤੋਂ ਉੱਤੇ ਕੁਛ ਨਹੀਂ ਹੈ